ਹੈਲੋ ਮੈਂ ਸੋਨੀਆ ਗੱਲ ਕਰ ਰਹੀ ਹਾਂ ਦੀਪਕ ਹੋਟਲ ਤੋਂ ਬੋਲ ਰਹੇ ਹੋ ਮੈਂ ਅੱਜ ਆਪਣਾ ਲੰਚ ਲੰਚ ਬੋਕਸ ਘਰ ਭੁੱਲ ਗਈ ਹਾਂ ਅਤੇ ਮੇਰਾ ਘਰ ਇੱਥੋਂ ਤਕਰੀਬਨ ਸੈਂਤੀ ਕੁ ਕਿਲੋਮੀਟਰ ਦੂਰ ਹੈ ਮੇਰੇ ਜਾਣ ਦਾ ਸਾਧਨ ਵੀ ਨਹੀਂ ਬਣ ਰਿਹਾ ਕੋਈ ਅਤੇ ਇੱਥੇ ਮੈਂ ਜੋਬ ਕਰਦੀ ਹਾਂ ਜੋਬ ਤੋਂ ਛੁੱਟੀ ਵੀ ਨਹੀਂ ਲੈ ਸਕਦੀ ਅਤੇ ਸਰ ਨੇ ਭੇਜਣਾ ਵੀ ਨਹੀਂ ਲੰਚ ਬੋਕਸ ਲੈਣ ਲਈ ਅਤੇ ਮੈਂ ਤੁਹਾਨੂੰ ਹੋਟਲ ਵਿੱਚ ਪੰਜ ਕੁ ਮਿੰਟ ਪਹਿਲਾਂ ਫੋਨ ਕਰਕੇ ਪੰਜ ਰੋਟੀਆਂ ਅਤੇ ਦਾਲ ਮੱਖਣੀ ਅਤੇ ਮਿਕਸ ਵੈਜੀਟੇਬਲ ਦਾ ਔਡਰ ਦਿੱਤਾ ਸੀ ਕਿਉਂਕਿ ਮੇਰੇ ਨਾਲ ਇੱਕ ਇੱਕ ਹੋਰ ਮੇਰੀ ਫਰੈਂਡ ਵੀ ਸੀ ਇਸ ਕਰਕੇ ਮੈਂ ਉਸਦਾ ਵੀ ਔਡਰ ਕਰ ਦਿੱਤਾ ਸੀ ਪਰ ਹੁਣ ਉਸਨੂੰ ਕੋਈ ਜ਼ਰੂਰ ਜ਼ਰੂਰੀ ਮੀਟਿੰਗ ਆ ਗਈ ਹੈ ਜਿਸ ਕਰਕੇ ਜਿਸ ਕਰਕੇ ਉਹ ਉੱਥੇ ਬਿਜੀ ਹੋ ਗਏ ਨੇ ਅਤੇ ਉਹ ਨਹੀਂ ਆ ਸਕਦੇ ਇਸ ਕਰਕੇ ਮੈਂ ਆਪਣਾ ਪੰਜ ਪੰਜ ਰੋਟੀਆਂ ਦਾ ਔਡਰ ਅਤੇ ਮਿਕਸ ਮਿਕਸ ਵੈਜੀਟੇਬਲ ਮਿਕਸ ਵੈਜੀਟੇਬਲ ਘਟਾ ਕੇ ਦੋ ਰੋਟੀਆਂ ਕਰਨਾ ਚਾਹੁੰਦੀ ਹਾਂ ਪਰ ਦਾਲ ਦੀ ਦਾਲ ਅਤੇ ਸਬਜ਼ੀ ਦੀ ਕੁਆਂਟਿਟੀ ਜਿੰਨਾ ਪਹਿਲਾ ਪਹਿਲਾ ਰਿਹਾ ਸੀ ਓਨੀ ਹੀ ਰੱਖੀ ਜਾਵੇ